ਸਕੂਲ ਵਿੱਚ ਮੇਰਾ ਮਨਪਸੰਦ ਵਿਸ਼ਾ ਪੰਜਾਬੀ ਸੀ ਜਿਹੜੀ ਕਿ ਮੇਰੀ ਮਾਤ ਭਾਸ਼ਾ ਦੇ ਨਾਲ ਸੰਬੰਧਿਤ ਸੀਗਾ ਇਸ ਦੇ ਵਿੱਚ ਮੈਂ ਆਪਣੇ ਮਨ ਦੇ ਹਾਵ ਭਾਵ ਅਤੇ ਦੂਸਰੇ ਵਿਚਾਰ ਅਰਾਮ ਦੇ ਨਾਲ ਸੁੱਖ ਦੇ ਮਈ ਢੰਗ ਨਾਲ ਲਿਖ ਸਕਦਾ ਸੀ ਅਤੇ ਮੈਨੂੰ ਬੜਾ ਆਨੰਦ ਆ ਰਿਹਾ ਸੀਗਾ ਕੋਈ ਮੈਂ ਗੱਲ ਸੁਣਦਾ ਉਸਨੂੰ ਹੂਬਹੂ ਪੰਜਾਬੀ ਵਿੱਚ ਲਗਾ ਮਾਤਰਾ ਦੇ ਨਾਲ ਠੀਕ ਲਿਖ ਦਿੰਦਾ ਅਤੇ ਬਾਕੀ ਵੀ ਉਸਦਾ ਚੰਗਾ ਆਨੰਦ ਮਾਣਦੇ ਸੀ ਇਸ ਕਰਕੇ ਪੰਜਾਬੀ ਮੇਰਾ ਮਨਪਸੰਦ ਵਿਸ਼ਾ ਸੀਗਾ